ਕਲਾਸਿਕਲ ਗਾਇਕੀ ਅਤੇ ਰਵਾਇਤੀ ਗਾਇਕੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਕਲਾਸਿਕਲ ਗਾਇਕੀ ਨੂੰ ਗਾਉਣ ਲਈ ਇੱਕ ਸੁਰਾਂ ਦੀ ਜਾਣਕਾਰੀ ਸੁਰਾਂ ਦੀ ਪਹਿਚਾਣ ਸਾਜਾਂ ਦੇ ਇੱਕ ਇੱਕ